ਜੇ ਮੇਰੀ ਗੱਲ ਕੀਤੀ ਜਾਵੇ ਤਾਂ ਮੈਂ ਆਪਣੇ ਗੀਤਾਂ ਦੀ ਚੋਣ ਕੁਛ ਇਸ ਤ ਪ੍ਰਕਾਰ ਕਰਦਾ ਹਾਂ ਛੋਟੇ ਹੁੰਦਿਆਂ ਤੋਂ ਜਦੋਂ ਵੀ ਆਪਾਂ ਸਕੂਲ ਜਾਈਦਾ ਹੈ ਕਿਤੇ ਵੀ ਜਾਈਦਾ ਹੈ ਖੇਡਾਂ ਖੇਡੀ ਦੀਆਂ ਹਨ ਜਾਂ ਕੋਈ ਵੀ ਸਪੋਰਟਸ ਵਰਕ ਕਰੀਦਾ ਹੈ ਆਪਾਂ ਕਿਤੇ ਵੀ ਜਾਂਦੇ ਹਾਂ ਜਾਂ ਕੋਈ ਬੁੱਕ ਰੀਡ ਕਰਦੇ ਹਾਂ ਜਾਂ ਆਸੇ ਪਾਸੇ ਦੇ ਲੋਕਾਂ ਨਾਲ ਵਿਚਰ ਕੇ ਸਾਨੂੰ ਪਤਾ ਲੱਗਦਾ ਹੈ ਦੁਨੀਆਂਦਾਰੀ ਦਾ ਕਿ ਹਿਸਾਬ ਕਿਤਾਬ ਹੈ ਸੋ ਕਈ ਬੰਦੇ ਤਾਂ ਹੁੰਦੇ ਹਨ ਇਮੋਸ਼ਨਲ ਹੁੰਦੇ ਹਨ ਕਈ ਬੰਦੇ ਸੈਂਸਟਿਵ ਹਨ ਮੈਂ ਸੈਂਸਟਿਵ ਵਾਲੇ ਪਾਸੇ ਹਾਂ ਕਿ ਜਦੋਂ ਵੀ ਮੈਨੂੰ ਕੋਈ ਘਟਨਾ ਮੇਰੇ ਨਾਲ ਵਾਪਰਦੀ ਹੈ ਜਾਂ ਕੁਛ ਵੀ ਸੈਂਸ ਸਾਡੇ ਨਾਲ ਵਾਪਰਿਆ ਹੁੰਦਾ ਹੈ ਕਿਤੇ ਵੀ ਆਪਾਂ ਜਾ ਰਹੇ ਹੋਈਏ ਤਾਂ ਉਸਨੂੰ ਇਮੋਸ਼ਨਲ ਬੰਦੇ ਦੀ ਟੈਂਡੈਸੀ ਹੁੰਦੀ ਹੈ ਕਿ ਉਹ ਆਪਣਾ ਰੋ ਕੇ ਜਾਂ ਕੁਛ ਵੀ ਕਰਕੇ ਉਸਨੂੰ ਪ੍ਰਗਟ ਕਰ ਦਿੰਦਾ ਹੈ ਬਾਹਰ ਸੈਂਸਟਿਵ ਜਿਹੜੇ ਹੁੰਦੇ ਹਨ ਉਹ ਆਪਣੀ ਗਾਇਕੀ ਦੇ ਅਨੁਸਾਰ ਆਪਣੇ ਅੰਦਰ ਜਜ਼ਮ ਕਰਦੇ ਹਨ ਆਪਣੇ ਅੰਦਰ ਰੱਖਦੇ ਹਨ ਅਤੇ ਫਿਰ ਹੌਲੀ ਹੌਲੀ ਉਹਨਾਂ ਦੀ ਗਾਇਕੀ ਦੇ ਨਾਲ ਬਾਹਰ ਨਿਕਲਦੇ ਹਨ ਉਹ ਚੀਜ਼ਾਂ ਜਿਹੜੇ ਕਿ ਲੋਕ ਲੋਕਾਂ ਦੇ ਨਾਲ ਰਿਲੇਟ ਕਰਦੀ ਹੈ ਅਤੇ ਲੋਕ ਵੀ ਉਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਹਨ ਅਤੇ ਫਿਰ ਇਸ ਪ੍ਰਕਾਰ ਅਸੀਂ ਗਾਣਾ ਰਿਕੋਡ ਕਰਦੇ ਹਨ ਅਤੇ ਰਿਕੋਡ ਕਰਨ ਤੋਂ ਬਾਅਦ ਉਹਦੇ ਵਿੱਚ ਲੇਅਰਿਕਸ ਐਡ ਕਰਦੇ ਹਨ ਅਤੇ ਲੇਅਰਿਕਸ ਐਡ ਕਰਨ ਤੋਂ ਬਾਅਦ ਮਿਊਜਿਕ ਉਸ ਹਿਸਾਬ ਨਾਲ ਦਿੰਦੇ ਹਾਂ ਤੋਂ ਇਸ ਪ੍ਰਕਾਰ ਨਾਲ ਸਾਡਾ ਗੀਤ ਤਿਆਰ ਹੁੰਦਾ ਹੈ ਜਿਹੜਾ ਕਿ ਲੋਕ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਹਨ